ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਮਨੋਰੰਜਨ ਦੇ ਸਾਧਨਾਂ ਵਿੱਚ ਲੋਕ ਗੀਤ ਲੋਕ ਨਾਚ ਬੋਲੀਆਂ ਨਾਟਕ ਨਕਲਾਂ ਥੀਏਟਰ ਆਦਿ ਸ਼ਾਮਿਲ ਹਨ ਪੰਜਾਬ ਦੇ ਲੋਕ ਨਾਚ ਜਾਂ ਲੋਕ ਗੀਤ ਸਿਰਫ ਮਨੋਰੰਜਨ ਦਾ ਹੀ ਸਾਧਨ ਨਹੀਂ ਹਨ ਬਲਕਿ ਇਹ ਸੱਭਿਆਚਾਰਕ ਇਤਿਹਾਸਿਕ ਰਾਜਸੀ ਸਮਾਜਿਕ ਨੈਤਿਕ ਤੌਰ 'ਤੇ ਵੀ ਪੰਜਾਬੀਆਂ ਦੇ ਜਨਜੀਵਨ ਦੇ ਨਾਲ ਜੁੜੇ ਹੋਏ ਹਨ ਪੰਜਾਬ ਦੇ ਜੇ ਲੋਕ ਨਾਚਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲੋਕ ਨਾਚਾਂ ਨੂੰ ਅਸੀਂ ਇਸਤਰੀਆਂ ਅਤੇ ਮਰਦਾਂ ਦੇ ਲੋਕ ਨਾਚਾਂ ਵਿੱਚ ਵੰਡ ਸਕਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਇਕੱਠੇ ਨਾਚ ਦੀ ਪਰੰਪਰਾ ਨਹੀਂ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਇਸ ਉੱਤੇ ਕੋਈ ਪਾਬੰਦੀ ਨਹੀਂ ਹੈ ਪੰਜਾਬ ਦੀਆਂ ਕੁੜੀਆਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਉੱਚੀਆਂ ਲੰਬੀਆਂ ਅਤੇ ਭਰਵੇਂ ਸਰੀਰ ਵਾਲੀਆਂ ਹੁੰਦੀਆਂ ਹਨ ਇਹਨਾਂ ਦੀ ਪੋਸ਼ਾਕ ਵੀ ਵੱਖਰੀ ਹੁੰਦੀ ਹੈ ਇਹ ਜ਼ਿਆਦਾਤਰ ਸਾਦਗੀ ਦੇ ਵਿੱਚ ਵਿਸ਼ਵਾਸ ਰੱਖਦੀਆਂ ਹਨ ਮਰਦਾਂ ਦੇ ਲੋਕ ਨਾਚ ਦੇ ਵਿੱਚ ਭੰਗੜਾ ਲੂਡੀ ਝੁੰਮਰ ਆਦਿ ਆਉਂਦੇ ਹਨ ਮਰਦਾਂ ਦਾ ਗਿੱਧਾ ਜਿਸ ਨੂੰ ਕਿ ਅੱਜ ਕੱਲ੍ਹ ਮਲਵਈ ਗਿੱਧਾ ਵੀ ਕਿਹਾ ਜਾਂਦਾ ਹੈ ਬਹੁਤ ਹੀ ਪ੍ਰਸਿੱਧ ਹੈ ਭੰਗੜੇ ਦੇ ਵਿੱਚ ਅਲਗੋਜੇ ਚਿਮਟੇ ਸੀਟੀ ਗੜਵੇ ਛੈਣੇ ਆਦਿ ਸਾਜ ਸੰਦ ਵਰਤੇ ਜਾਂਦੇ ਹਨ ਪੰਜਾਬ ਦੇ ਲੋਕ ਨਾ ਨਾਚਾਂ ਨੇ ਪੰਜਾਬੀਆਂ ਦੀ ਸੱਭਿਆਚਾਰਕ ਕੇਂਦਰਾਂ ਪਿੰਡਾਂ ਬੇਲਿਆਂ ਸਟੇਜ ਤੋਂ ਫਿਲਮਾਂ ਅਤੇ ਟੈਲੀਵਿਜਨ ਤੱਕ ਦਾ ਸਫਰ ਤੈਅ ਕੀਤਾ ਹੈ ਪੰਜਾਬੀ ਗਾਇਕੀ ਉੱਤੇ ਵਿਦੇਸ਼ੀ ਪ੍ਰਭਾਵ ਦਾ ਅਸਰ ਬਹੁਤ ਹੀ ਦਿੱਖ ਰਿਹਾ ਹੈ ਅੱਜ ਕੱਲ੍ਹ ਪੰਜਾਬੀ ਪੋਪ ਸੌਂਗਜ਼ ਹਰ ਥਾਂ 'ਤੇ ਵੱਜਦੇ ਸੁਣਾਈ ਦਿੰਦੇ ਹਨ ਮਨੋਰੰਜਨ ਦੇ ਸਾਧਨਾਂ ਦੇ ਵਿੱਚ ਥੀਏਟਰ ਅਤੇ ਨਾਟਕ ਦਾ ਵੀ ਅਹਿਮ ਰੋਲ ਹੈ ਅੱਜ ਵੀ ਲੋਕ ਨਾਟਕਾਂ ਅਤੇ ਥੀਏਟਰ ਨੂੰ ਬੜੀ ਹੀ ਦਿਲਚਸਪੀ ਦੇ ਨਾਲ ਵੇਖਦੇ ਹਨ ਧੰਨਵਾਦ ਜੀ